ਮੇਰਾ ਨਾਂ ਰਾਹੁਲ ਲਲੋਤਰਾ ਹੈ ਅਤੇ ਮੈਂ ਇਸ ਵੈਬਸਾਈਟ ਤੋਂ ਆਪਣੇ ਲਈ ਲੈਪਟੋਪ ਮੰਗਾਇਆ ਸੀ ਅਤੇ ਮੇਰੇ ਲੈਪਟੋਪ ਦਾ ਨਾਂ ਐਮ ਐਸ ਆਈ ਸੋਡ ਪੰਦਰਾਂ ਹੈ ਇਹ ਬਹੁਤ ਹੀ ਵਧੀਆ ਲੈਪਟੋਪ ਹੈ ਇਸਦੇ ਵਿੱਚ ਆਈ ਸੈਵੇਨ ਤੇਰਾਂ ਜਨਰੇਸ਼ਨ ਹੈ ਅਤੇ ਇਸ ਦੇ ਵਿੱਚ ਰੈਮ ਸੋਲਾਂ ਜੀ ਬੀ ਪਈ ਹੋਈ ਹੈ ਅਤੇ ਨਾਲ ਐਸ ਐਸ ਡੀ ਵੀ ਦੋ ਟੀ ਬੀ ਦੀ ਹੈ ਅਤੇ ਇਸ ਦੀ ਜਿਹੜੀ ਸਕਰੀਨ ਹੈ ਇਹ ਟੂ ਕੇ ਟੂ ਫੋਟੀ ਹਟਸ ਦੀ ਹੈ ਅਤੇ ਜਿਹੜੇ ਇਸਦੇ ਸਪੀਕਰ ਪਏ ਹੋਏ ਨੇ ਉਹਨਾਂ ਦੀ ਆਵਾਜ਼ ਬਹੁਤ ਹੀ ਵਧੀਆ ਹੈ ਅਤੇ ਫਿਲਮ ਵ ਮੂਵੀ ਵਗੈਰਾ ਵੇਖਣ 'ਚ ਇਹ ਕਾਫੀ ਵਧੀਆ ਲੱਗਦੇ ਨੇ ਅਤੇ ਇਸ ਦੇ ਨਾਲ ਮੈਂ ਆਪਣਾ ਕੋ ਕੋਡਿੰਗ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰ ਪਾਉਂਦਾ ਹਾਂ ਇਸ ਦੀ ਸਪੀਡ ਕੋਡਿੰਗ 'ਚ ਬਹੁਤ ਹੀ ਵਧੀਆ ਹੈ ਅਤੇ ਇਸ ਦੇ ਉੱਤੇ ਮੈਂ ਗੇਮ ਵੀ ਵਧੀਆ ਤਰੀਕੇ ਨਾਲ ਖੇਡ ਪਾਉਂਦਾ ਹਾਂ ਇਹ ਮੇਰੇ ਪਿਛਲੇ ਲੈਪਟੋਪ ਦੇ ਨਾਲੋਂ ਬਹੁਤ ਹੀ ਵਧੀਆ ਹੈ ਅਤੇ ਇਸ ਕੰਪਨੀ ਦੇ ਨਾਲ ਮੈਨ ਮੈਨੂੰ ਇੱਕ ਹੈਡਫੋਨ ਵੀ ਫਰੀ ਦਿੱਤੇ ਗਏ ਨੇ ਜੋ ਕਿ ਇਸ ਦੇ ਔਡਰ ਵਿੱਚ ਨਹੀਂ ਜਿਸ ਕਰਕੇ ਮੈਂ ਕਾ ਕੰਪਨੀ ਤੋਂ ਕਾਫੀ ਖੁਸ਼ ਹਾਂ